ਇਕ ਦਿਨ ਮੈਂ ਆਪਣਾ ਫੋਨ 'ਚ ਫਲਿਪਕਾਰਟ ਖੋਲ੍ਹ ਕੇ ਫਲਿਪਕਾਰਟ ਚਲਾ ਰਿਹਾ ਤਾਂ ਉੱਧਰ ਸਾਹਮਣੇ ਮੇਰੇ ਇੱਕ ਫੈਨ ਆਇਆ ਜਿਹਦੇ 'ਚ ਉਹਦੇ ਡਿਸਕਾਊਂਟ 'ਚ ਚੱਲ ਰਿਹਾ ਤਾਂ ਔਫਰ 'ਚ ਲੱਗੇ ਵੇ ਤੇ ਉਹ ਫੈਨ ਮੈਂ ਔਡਰ ਕਰਿਆ ਉਹ ਫੈਨ ਜਿੱਦਾਂ ਦਾ ਮੈਂ ਔਡਰ ਕਰਿਆ ਉਹ ਜਦੋਂ ਮੇਰੇ ਕੋਲ ਆਇਆ ਉਹ ਫੈਨ ਉਸ ਤਰ੍ਹਾਂ ਦਾ ਨਹੀਂ ਤਾ ਉਹਦੇ ਪੱਖੇ ਹੋਰ ਤਰ੍ਹਾਂ ਦੇ ਰੰਗ ਦੇ ਤੇ ਉਹਦਾ ਜਿਹੜਾ ਘੁੰਮਣ ਵਾਲਾ ਉਹ ਸਾਰੇ ਚੇਂਜ ਤਾ ਪਤਲੇ ਪਤਲੇ ਪੱਖੀਆਂ ਤੀਆਂ ਉਹਦੀਆਂ ਸਾਰੇ ਰੰਗ ਹੋਰ ਤੇ ਚਲ ਜਦੋਂ ਆਪਾਂ ਫਿਟ ਕਰਾਇਆ ਉਹ ਚੱਲੇ ਹੀ ਨਾ ਉਹ 'ਚ ਬਹੁਤ ਪ੍ਰੋਬਲਮ ਪਤਾ ਨਹੀਂ ਕਿਆ ਪ੍ਰੋਬਲਮ ਦਾ ਖ਼ਰਾਬ ਤਾ ਇਹੋ ਜਿਹਾ ਗੰਦਾ ਜਿਹਾ ਕੋਈ ਪੱਖਾ ਮੈਂ ਦੇਖਿਆ ਨਹੀਂ ਮੈਂ ਹਜੇ ਤੱਕ ਇੰਨਾ ਗੰਦਾ ਪੱਖਾ ਉਹ ਚੱਲਦਾ ਨਾ ਵਾਸਤਾ ਕੁਝ ਉਹ ਪੱਖੇ 'ਚ ਬਹੁਤ ਕਮੀ ਦੀ ਤਾਰਾਂ ਤੂਰਾਂ ਵੀ ਸਾਰੀ ਕੱਟੀਆਂ ਵੀ ਆ ਤੀਆਂ ਰੰਗ ਦਾ ਸਾਰਾ ਝੜੇ ਵੇ ਤੇ ਜੇ ਐਂ ਲੱਗ ਰਿਹਾ ਤਾ ਵੀ ਪੁਰਾਣਾ ਪੱਖਾ ਮੇਰੇ ਕੋਲ ਆ ਗਿਆ ਐਨ ਇੰਨਾ ਗੰਦਾ ਮੈਨੂੰ ਸ਼ੋਪਿੰਗ ਦਾ ਬਹੁਤ ਸ਼ੌਕ ਹੈ ਔਨਲਾਈਨ ਸ਼ਾਪਿੰਗ ਦਾ ਪਰ ਇੰਨਾ ਗੰਦਾ ਪੱਖਾ ਨਹੀਂ ਦੇਖਿਆ ਆਪਾਂ ਇਹੋ ਜਿਹੇ ਪੱਖੇ ਨਾਲ ਕੀ ਫ਼ਾਇਦਾ ਆਪਣੇ ਅਸੀਂ ਜ ਭਰੋਸਾ ਕਰਕੇ ਮੰਗਵਾਉਂਦੇ ਉਹ ਭਰੋਸਾ ਇਹੋ ਜਿਹਾ ਕੋਈ ਹੈ ਨਹੀਂ ਗੰਦਾ ਹੀ ਖ਼ਰਾਬ ਕ ਪੱਖਾ ਤਾਂ ਉਹ